ਭਾਰਤ ਦੀਆਂ ਜਿਹੜੀਆਂ ਪ੍ਰਸਿੱਧ ਖੇਡਾਂ ਨੇ ਉਹਦੇ ਵਿੱਚੋਂ ਸਭ ਤੋਂ ਮਸ਼ਹੂਰ ਤਾਂ ਹੋਕੀ ਹੋ ਗਈ ਕ੍ਰਿਕਟ ਹੋ ਗਿਆ ਕਬੱਡੀ ਫੁੱਟਬੋਲ ਅਤੇ ਕੁਸ਼ਤੀ ਅਤੇ ਸਾਡੇ ਦੇਸ਼ ਦੇ ਵਿੱਚ ਅਥਲੀਟ ਬਹੁਤ ਨੇ ਨਾਮੇ ਪਰਵਾਨੇ ਬਹੁਤ ਅਥਲੀਟ ਨੇ ਪਰ ਮੈਂ ਗੱਲ ਕਰਨਾ ਚਾਹਾਂਗਾ ਸਾਡੇ ਪਟਿਆਲਾ ਦੀ ਸਰਦਾਰਨੀ ਮਾਨ ਕੌਰ ਦੀ ਜਿਹੜੇ ਕਿ ਇੱਕ ਸੌ ਦੋ ਸਾਲ ਦੇ ਨੇ ਬਹੁਤ ਬਜ਼ੁਰਗ ਨੇ ਅਤੇ ਉਹ ਅੱਜ ਦੇ ਸਮੇਂ ਦੇ ਵਿੱਚ ਵੀ ਮੈਰਾਥੋਨ ਵਗੈਰਾ ਦੋ ਸੌ ਮੀਟਰ ਚਾਰ ਸੌ ਮੀਟਰ ਅਲੱਗ ਅਲੱਗ ਰੇਸਾਂ ਦੇ ਵਿੱਚ ਭਾਗ ਲੈਂਦੇ ਨੇ ਅਤੇ ਉਹ ਅੱਜ ਦੇ ਯੂਥ ਦੇ ਲਈ ਇਨਸਪੀਰੇਸ਼ਨ ਨੇ ਕਿ ਉਹ ਇੰਨੀ ਉਮਰ ਦੇ ਹੋ ਕੇ ਵੀ ਹੁਣ ਵੀ ਆਪਣਾ ਜਿਹੜਾ ਹੈਗਾ ਉਨ੍ਹਾਂ ਨੇ ਛੱਡਿਆ ਨਹੀਂ ਹੈਗਾ ਮਿਹਨਤ ਕਰਨਾ ਅਤੇ ਉਹ ਅ ਬਾਕੀਆਂ ਨੂੰ ਇਨਸਪਾਇਰ ਜਿੱਥੇ ਕਰਦੇ ਨੇ ਠੀਕ ਹੈ ਅਤੇ ਨਾਲ ਨਾਲ ਉਹ ਯੂਥ ਨੂੰ ਗਾਈਡ ਵੀ ਕਰਦੇ ਨੇ ਕਿ ਤੁਸੀਂ ਕਿਵੇਂ ਚੰਗੇ ਅਥਲੀਟ ਬਣ ਸਕਦੇ ਹੋ ਕਿਹੜੀ ਚੀਜ਼ਾਂ ਦਾ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਅਤੇ ਉਨ੍ਹਾਂ ਦਾ ਜਨਮ ਇੱਕ ਮਾਰਚ ਦੋ ਹਜ਼ਾਰ ਉੱਨੀ ਉੱਨੀ ਸੌ ਸੌਲ੍ਹਾਂ ਦਾ ਸੌਰੀ ਠੀਕ ਹੈ ਜੀ ਅਤੇ ਉਹ ਅ ਵੈਸੇ ਤਾਂ ਉਹਨਾਂ ਦੀ ਹੁਣ ਉਹ ਪੂਰੇ ਹੋ ਚੁੱਕੇ ਨੇ ਦੋ ਹਜ਼ਾਰ ਇੱਕੀ ਦੇ ਵਿੱਚ ਠੀਕ ਹੈ ਅਤੇ ਪਰ ਉਹ ਅੱਜ ਵੀ ਸਾਡੇ ਯੂਥ ਦੇ ਲਈ ਇੱਕ ਆਈਕਨ ਨੇ